ਹਾਂਜੀ ਅੱਛਾ ਜੀ ਨਹੀਂ ਉਹ ਘਰ ਨਹੀਂ ਏ ਅੱਛਾ ਇੱਥੇ ਦੋ ਤਿੰਨ ਮੋ ਮੋਲ ਵਗੈਰਾ ਹੈਗੇ ਹੈ ਜਿੱਦਾਂ ਕਿ ਰਿਲਾਈਂਸ ਈਜ਼ੀ ਡੇ ਮੋਲ ਅਤੇ ਵਿਸ਼ਾਲ ਮੈਗਾ ਮਾਰਟ ਇੱਥੇ ਫਰੈਸ਼ ਸਬਜ਼ੀਆਂ ਮਿਲ ਜਾਣਗੀਆਂ ਤੁਹਾਨੂੰ ਠੀਕ ਹੈ ਬਾਕੀ ਬਜ਼ਾਰ ਦੇ ਵਿੱਚ ਛੋਟੀਆਂ ਛੋਟੀਆਂ ਦੁਕਾਨਾਂ ਹੈਗੀਆਂ ਉੱਥੇ ਵੀ ਮਿਲ ਜਾਣਗੀਆਂ ਥੋੜ੍ਹਾ ਮੋਲ ਭਾਵ ਕਰਨਾ ਪਏਗਾ ਮੋਲ 'ਚ ਤਾਂ ਦੋਖੋ ਰੇਟ ਜ਼ਿਆਦਾ ਹੀ ਹੁੰਦਾ ਬਸ ਜਿਹੜੀਆਂ ਬਜ਼ਾਰ 'ਚ ਦੁਕਾਨਾਂ ਉਨ੍ਹਾਂ ਦਾ ਥੋੜ੍ਹਾ ਸਹੀ ਹੁੰਦਾ ਹੈ ਹਾਂਜੀ ਹਾਂਜੀ ਉਹ ਹਫਤੇ 'ਚ ਦੋ ਦਿਨ ਲੱਗਦੀ ਹੈ ਮੰਡੀ ਬੁੱਧਵਾਰ ਅਤੇ ਸ਼ਨੀਵਾਰ ਉਹ ਜ਼ੈਲ ਸਿੰਘ ਕਲੋਨੀ ਉਹ ਤੁਸੀਂ ਵੈਸੇ ਤਾਂ ਬੇਲਾ ਚੌਂਕ ਤੋਂ ਹੀ ਮਿਲ ਜੇਗਾ ਅਗਰ ਓਟੋ 'ਚ ਜਾਣਾ ਹੈ ਵੈਸੇ ਅਗਰ ਤੁਸੀਂ ਪੈਦਲ ਜਾਣਾ ਤਾਂ ਵੀ ਜਾ ਸਕਦੇ ਹੋ ਕਿਉਂਕਿ ਬੇਲਾ ਚੌਂਕ ਤੋਂ ਜ਼ੈਲ ਸਿੰਘ ਨਗਰ ਜ਼ਿਆਦਾ ਦੂਰ ਨਹੀਂ ਹੈ

ਬੇਲਾ ਚੌਂਕ ਦੇ ਨਾਲ ਹੀ ਮੇਨ ਮਾਰਕਿਟ ਹੈ ਉਹਦੇ ਵਿੱਚ ਬਹੁਤ ਸਾਰੀਆਂ ਸ਼ੋਪਸ ਹੈ ਉੱਥੇ ਤੁਹਾਨੂੰ ਇੱਦਾਂ ਮਤਲਬ ਕਰਿਆਨਾ ਵਗੈਰਾ ਮਿਲ ਜੇਗਾ ਹਾਂਜੀ ਓਕੇ